ਪਹਿਲੀ ਗੱਲ ਤਾਂ ਜੀ ਤੁਸੀਂ ਪੁੱਛਿਆ ਤੁਹਾਡੇ ਪਿੰਡ ਦੀ ਸਤਾਨ ਸਥਾਨਕ ਖੁਰਾਕ ਕੌਣ ਹੈ ਅਤੇ ਉਸਦੀ ਪੂਜਾ ਵਿੱਚ ਕੀ ਸਾਰੇ ਰੀਤੀ ਰਿਵਾਜ਼ ਦੇਖੇ ਜਾਂਦੇ ਹਨ ਮੈਨੂੰ ਉਰੇ ਖੁਰਾਕ ਦਾ ਮਤਲਬ ਵੈਸੇ ਪਤਾ ਨਹੀਂ ਲੱਗ ਰਿਹਾ ਮੈਨੂੰ ਲੱਗਦਾ ਕਿ ਉਰੇ ਤੁਹਾਡੇ ਪਿੰਡ ਦੀ ਕੋਈ ਸਥਾਨਕ ਜਗ੍ਹਾ ਪੁੱਛੀ ਸਥਾਨਕ ਜਗ੍ਹਾ ਕਿਹੜੀ ਹੈ ਤਾਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਾਡੇ ਪਿੰਡ ਜਿਹੜੀ ਸਥਾਨਕ ਜਗ੍ਹਾ ਹੈ ਉੱਥੇ ਇੱਕ ਕਿਆ ਹੈ ਮੰਦਰ ਹੈ ਇੱਕ ਤਾਂ ਮੰਦਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਹਾਂ ਉੱਥੇ ਹਰ ਸਾਲ ਇੱਕ ਮੇਲਾ ਲੱਗਦਾ ਬਾਬਿਆਂ ਦਾ ਮੇਲਾ ਮੇਲੇ ਵਿੱਚ ਤੁਹਾਨੂੰ ਪਤਾ ਹੈ ਬੱਚੇ ਬਜ਼ੁਰਗ ਮਾਂਵਾਂ ਭੈਣਾਂ ਸਾਰੇ ਰਲ ਮਿਲ ਕੇ ਆਉਂਦੀਆਂ ਨੇ ਅਤੇ ਉੱਥੇ ਝੂਲੇ ਵੀ ਲਗਾਏ ਜਾਂਦੇ ਨੇ ਬੱਚਿਆਂ ਲਈ ਮਿਠਾਈਆਂ ਬਣਦੀਆਂ ਨੇ ਅਤੇ ਇੱਕ ਵੱਡਾ ਸਾਰਾ ਲੰਗਰ ਵੀ ਲੱਗਦਾ ਉਸ ਦਿਨ ਪੂਜਾ ਹੁੰਦੀ ਹੈ ਮਾਤਾ ਸ਼ੀਤਲਾ ਦੇਵੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਉਸ ਦਿਨ ਇਸ ਤੋਂ ਇਲਾਵਾ ਕਿਸ ਰਾਤ ਨੂੰ ਉਹ ਐਚੁਲੀ ਜਿਹੜਾ ਹੈ ਚਲਦਾ ਐਵੇਂ ਜਿਹੜਾ ਲੰਗਰ ਵਗੈਰਾ ਹੁੰਦਾ ਹੈ ਇਹ ਰਾਤ ਦਾ ਪ੍ਰੋਗਰਾਮ ਹੁੰਦਾ ਹੈ ਅਤੇ ਦਿਨੇ ਪੂਜਾ ਕੀਤੀ ਜਾਂਦੀ ਹੈ ਮਾਤਾ ਸ਼ੀਤਲਾ ਦੇਵੀ ਜੀ ਦੀ ਅਤੇ ਵੈਸੇ ਇਸ ਤੋਂ ਇਲਾਵਾ ਤਾਂ ਹੋਰ ਸਾਡੇ ਮਤ ਉੱਥੇ ਇੱਕ ਇਸ ਤੋਂ ਇਲਾਵਾ ਸਾਡੇ ਇੱਕ ਗੁਰੂ ਦੀ ਮਸੀਤ ਵੀ ਹੈ ਗੁਰੂ ਦੀ ਮਸੀਤ ਕਰਕੇ ਵੀ ਹੈ ਜੋ ਕਿ ਪੁਰਾਣੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਬਣਵਾਈ ਸੀ ਤਾਂ ਉਹ ਵੀ ਇੱਕ ਸਾਡੇ ਪਿੰਡ ਦੇ ਵਿੱਚ ਮਹੱਤਵਪੂਰਨ ਜਗ੍ਹਾ ਮੰਨੀ ਜਾਂਦੀ ਹੈ